ਸਾਡੇ ਪੰਜਾਬ ਵਿੱਚ ਬਹੁਤ ਜ਼ਿਆਦਾ ਪਕਵਾਨ ਹਨ ਜੋ ਬਹੁਤ ਜ਼ਿਆਦਾ ਮਸ਼ਹੂਰ ਹਨ ਜਿਵੇਂ ਮੱਕੀ ਦੀ ਰੋਟੀ ਸਰੋਂ ਦਾ ਸਾਗ ਸਰਦੀਆਂ ਵਿੱਚ ਆਉਂਦਾ ਹੈ ਸਭ ਲੋਕ ਬਹੁਤ ਜਿਆਦਾ ਪਸੰਦ ਕਰਦੇ ਹਨ ਨਾਲ ਲੱਸੀ ਹੋਵੇ ਨਾਲ ਇੱਥੋਂ ਦੇ ਜੋ ਵੀ ਮਸਾਲੇਦਾਰ ਚੀਜ਼ਾਂ ਭੋਜਨ ਚਾਂਪਾ ਸਮੋਸੇ ਨੂਡਲਸ ਕੀ ਕਹਿੰਦੇ ਆ ਡੋਸਾ ਇਡਲੀ ਵਗੈਰਾ ਬਹੁਤ ਜ਼ਿਆਦਾ ਲੋਕੀ ਪਸੰਦ ਕਰਦੇ ਹਨ ਮਸਾਲੇਦਾਰ ਚੀਜ਼ਾਂ ਹੋ ਗਈਆਂ ਪੰਜਾਬ ਦੇ ਲੋਕ ਖਾਣ 'ਚ ਬਹੁਤ ਸ਼ੌਕੀਨ ਹੈਗੇ ਆ ਸਾਡੇ ਪੰਜਾਬੀ ਲੋਕਾਂ ਨੂੰ ਬਸ ਖਾਣਾ ਮਿਲ ਜਾਵੇ ਬਹੁਤ ਜ਼ਿਆਦਾ ਸ਼ੋਕੀਨ ਹੈਗੇ ਖਾਣ ਦੇ ਅਤੇ ਇਹਨਾਂ ਨੂੰ ਮਸਾਲੇਦਾਰ ਚੀਜ਼ਾਂ ਵੀ ਬਹੁਤ ਜ਼ਿਆਦਾ ਸਾਨੂੰ ਸਾਨੂੰ ਖ਼ੁਦ ਦੇ ਆਪਾਂ ਖ਼ੁਦ ਪੰਜਾਬੀ ਹਾਂ ਇਸ ਲਈ ਸਾਨੂੰ ਪੰਜਾਬੀ ਲੋਕਾਂ ਨੂੰ ਮਸਾਲੇਦਾਰ ਚੀਜ਼ਾਂ ਬਹੁਤ ਜ਼ਿਆਦਾ ਪਸੰਦ ਹਨ ਇਥੋਂ ਦਾ ਮਲਾਈ ਮਲਾਈ ਮਲਾਈ ਕੋਫ਼ਤਾ ਮਲਾਈ ਕੋਫ਼ਤਾ ਬਹੁਤ ਜ਼ਿਆਦਾ ਪਸੰਦ ਹੈ ਇਥੋਂ ਦਾ ਭਲਵਾਨ ਦਾ ਕੁਲਚਾ ਬਹੁਤ ਜ਼ਿਆਦਾ ਪਸੰਦ ਹੈ ਪੂਰੀ ਛੋਲੇ ਵਗੈਰਾ ਸਭ ਕਿਉਂਕਿ ਪੰਜਾਬ ਦਾ ਖਾਣਾ ਬਹੁਤ ਵਧੀਆ ਹੈ ਇਸ ਲਈ ਪੰਜਾਬ ਦਾ ਖਾਣਾ ਮੱਕੀ ਦੀ ਰੋਟੀ ਸਰਦੀਆਂ ਵਿੱਚ ਆਉਂਦੀ ਹੈ ਲੋਕ ਜ਼ਰੂਰ ਖਾਂਦੇ ਹਨ ਬਹੁਤ ਖੁਸ਼ ਹੁੰਦੇ ਹਨ ਲੱਸੀ ਜ਼ਰੂਰ ਪੀਂਦੇ ਮੱਕੀ ਰੋਟੀ ਦੇ ਨਾਲ ਲੱਸੀ ਜ਼ਰੂਰ ਪੀਤੀ ਜਾਂਦੀ ਹੈ ਦਹੀਂ ਦੁੱਧ ਵਗੈਰਾ ਪਨੀਰ ਪੰਜਾਬ ਦਾ ਬਹੁਤ ਜ਼ਿਆਦਾ ਸ਼ੁੱਧ ਹੈਗਾ ਵਾ ਇਸ ਲਈ ਬੱਚੇ ਵੀ ਅੱਜ ਕੱਲ੍ਹ ਇਹੋ ਜਿਹੀਆਂ ਚੀਜ਼ਾਂ ਦੇ ਬਹੁਤ ਜ਼ਿਆਦਾ ਸ਼ੋਕੀਨ ਹੈਗੇ ਹੈ ਜੋ ਬੱਚੇ ਹੈ ਮੋਮੋਸ ਵਗੈਰਾ ਚਾਂਪ ਵਗੈਰਾ ਇਹ ਕੁਛ ਖਾਂਦੇ ਆ ਅਤੇ ਬਸ ਖੁਸ਼ ਰਹਿੰਦੇ ਆ ਓਕੇ ਜੀ